ਸਤਿ ਸ਼੍ਰੀ ਅਕਾਲ ਜੀ ਜੇ ਆਪਾਂ ਸੈਰ ਸਪਾਟੇ ਦੀ ਗੱਲ ਕਰੀਏ ਤਾਂ ਜਿਹੜਾ ਧਰਮ ਜਿਹੜੇ ਗੁਰਦੁਆਰਾ ਆ ਅਤੇ ਮੰਦਿਰ ਆ ਜਾਂ ਕੋਈ ਵੀ ਧਾਰਮਿਕ ਸਥਾਨ ਆ ਉਹ ਪਹਿਲਾਂ ਤਾਂ ਇਹ ਮਤਲਬ ਬੰਦੇ ਦਾ ਉਹ ਨਹੀਂ ਕਰਦਾ ਕਿ ਸਿਰਫ਼ ਇਸ ਧਰ ਇਸ ਧਰਮ ਦਾ ਬੰਦਾ ਇਸ 'ਚ ਆਵੇ ਕੋਈ ਵੀ ਜਿਹੜਾ ਆ ਉਹ ਜਾ ਸਕਦਾ ਇੱਥੇ ਜਾਤ ਦਾ ਪਾਤ ਦਾ ਕੋਈ ਫ਼ਰਕ ਨਹੀਂ ਕੀਤਾ ਜਾਂਦਾ ਸਭ ਤੋਂ ਵੱਡੀ ਇਹਦੀ ਐਗਜਾਂਪਲ ਆ ਜਿਹੜੀ ਉਹ ਆਪਣਾ ਦਰਬਾਰ ਸਾਹਿਬ ਆ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਇਹੀ ਦਰਸਾਉਂਦੇ ਆ ਕਿ ਕੋਈ ਵੀ ਇਸ ਕੋਈ ਵੀ ਧਰਮ ਦਾ ਕਿਸੇ ਵੀ ਧਰਮ ਦਾ ਇਸ ਦਰਵਾਜੇ 'ਤੇ ਆ ਜਾ ਸਕਦਾ ਆ ਉਹ ਚਾਰਾਂ ਦਰਵਾਜੇ ਆ ਉਹ ਦਰਸਾਉਂਦੇ ਆ ਕਿ ਇੱਥੇ ਧਰਮ ਦਾ ਕੋਈ ਉਹ ਨਹੀਂ ਹੈਗਾ ਕਿ ਸਿਰਫ਼ ਇਸ ਧਰਮ ਦਾ ਬੰਦਾ ਆਵੇ ਕੋਈ ਜਾਤ ਪਾਤ ਦਾ ਉੱਥੇ ਭੇਦ ਭਾਵ ਨਹੀਂ ਹੈਗਾ ਫਿਰ ਜਦੋਂ ਆਪਾਂ ਜੌੜੇ ਜਮ੍ਹਾ ਕਰਾਉਂਦੇ ਹਾਂ ਉਦੋਂ ਵੀ ਇਹੀ ਚੀਜ਼ ਦਰਸਾਈ ਜਾਂਦੀ ਆ ਜਦੋਂ ਪ੍ਰਸ਼ਾਦਾ ਆਪਾਂ ਛਕਦੇ ਹਾਂ ਉਦੋਂ ਪ੍ਰਸ਼ਾਦਾ ਛਕਣ ਲੱਗੇ ਵੀ ਜਦੋਂ ਸਾਰੀ ਸੰਗਤ ਬੈਠੀ ਹੁੰਦੀ ਆ ਉਹਦੇ ਵਿੱਚ ਇਹ ਨਹੀਂ ਵੇਖਿਆ ਜਾਂਦਾ ਕੋਈ ਛੋਟੀ ਜਾਤ ਦਾ ਆ ਕੋਈ ਵੱਡੀ ਜਾਤ ਦਾ ਆ ਕੋਈ ਹਿੰਦੂ ਆ ਕੋਈ ਮੁਸਲਿਮ ਆ ਕੋਈ ਸਿੱਖ ਆ ਸਭ ਨੂੰ ਇੱਕ ਨਜ਼ਰ ਨਾਲ ਦੇਖਿਆ ਜਾਂਦਾ ਆ ਸਭ ਨੂੰ ਉੱਥੇ ਪ੍ਰਸ਼ਾਦਾ ਮਤਲਬ ਛਕਾਇਆ ਜਾਂਦਾ ਆ ਗੁਰੂ ਜੀ ਨੇ ਸਭ ਤੋਂ ਜਿਹੜਾ ਸੀਗਾ ਲੰਗਰ ਦੀ ਜਿਹੜੀ ਸੀਗੀ ਉਹ ਸ਼ੁਰੂਆਤ ਹੀ ਇਸ ਮਕਸਦ ਨਾਲ ਕੀਤੀ ਸੀਗੀ ਕਿ ਇਸ ਵਿੱਚ ਕਿਸੇ ਵੀ ਜਾਤ ਪਾਤ ਦਾ ਕੋਈ ਵੀ ਇੱਦਾਂ ਧਰਮ ਦਾ ਕੁਛ ਵੀ ਇੱਦਾਂ ਰੋਲਾ ਨਾ ਪਵੇ ਸਭ ਨੂੰ ਗੁਰੂ ਜੀ ਇੱਕ ਸਾਥ ਰੱਖਣਾ ਚਾਹੁੰਦੇ ਸੀਗੇ ਤਾਂ ਕਰਕੇ ਉਹਨਾਂ ਨੇ ਲੰਗਰ ਦੀ ਜਿਹੜੀ ਆ ਉਹ ਸੇ ਸੇਵਾ ਸ਼ੁਰੂ ਕੀਤੀ ਫਿਰ ਜੋੜਿਆਂ ਦੀ ਸੇਵਾ ਵੀ ਉਹਨਾਂ ਨੇ ਇਸ ਕਰਕੇ ਸ਼ੁਰੂ ਕੀਤੀ ਜਿਹੜਾ ਉੱਥੇ ਕੋਈ ਵੀ ਰਾਜਾ ਸੀ ਕੋਈ ਵੀ ਸੀਗਾ ਕਿਸੇ ਵੀ ਧਰਮ ਦਾ ਜਾਂ ਕੋਈ ਵੱਡਾ ਕੋਈ ਛੋਟਾ ਕਿਸੇ ਵੀ ਜਾਤ ਦਾ ਕੋਈ ਵੀ ਸੀਗਾ ਉਹ ਸਾਰੇ ਮਤਲਬ ਜੋ ਜੋੜਿਆਂ ਦੀ ਸੇਵਾ ਕਰਾਉਂਦੇ ਸੀ ਸਭ ਤੋਂ ਪਹਿਲਾਂ ਤਾਂ ਜੋੜਿਆਂ ਦੀ ਸੇਵਾ ਗੁਰੂ ਜੀ ਨੇ ਹੀ ਸ਼ੁਰੂ ਕੀਤੀ ਸੀਗੀ ਗੁਰੂ ਰਾਮਦਾਸ ਜੀ ਨੇ ਜੋੜਿਆਂ ਦੀ ਸੇਵਾ ਸ਼ੁਰੂ ਕੀਤੀ ਸੀਗੀ ਗੁਰੂ ਦ ਰਾਮਦਾਸ ਜੀ ਦਾ ਗੁਰਦੁਆਰਾ ਆ ਰਾਮਦਾਸ ਜਿਹਨੂੰ ਆਪਾਂ ਦਰਬਾਰ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ ਜਿਹੜਾ ਉਹ ਰਮਦਾਸ ਆ ਨਾ ਆਪਣਾ ਗੁਰਦੁਆਰਾ ਦਰਬਾਰ ਸਾਹਿਬ ਕਿਸੇ ਨੂੰ ਸ਼ਾਇਦ ਨਾ ਪਤਾ ਹੋਵੇ ਪਰ ਜਿਹੜੇ ਰਾਮ ਗੁਰੂ ਰਾਮਦਾਸ ਜੀ ਆ ਨਾ ਉਹ ਜਦੋਂ ਬਚਪਨ 'ਚ ਸੀਗੇ ਨਾ ਉਹਨਾਂ ਨੇ ਮਤਲਬ ਬੜਾ ਬੜਾ ਔਖਾ ਟਾਈਮ ਦੇਖਿਆ ਹੈ ਉਹ ਕਿੰਨਾਂ ਭੁੱਖੇ ਸੌਂਦੇ ਸੀਗੇ ਪਰ ਇੱਕ ਅੱਜ ਦਾ ਟਾਈਮ ਆ ਕਿ ਉਹਨਾਂ ਦੀ ਸਾਰੀ ਸੰਗਤ ਜਿਹੜੀ ਆ ਉਹ ਰੱਜ ਕੇ ਉਹਨਾਂ ਦੇ ਦਰਬਾਰ ਸਾਹਿਬ ਤੋਂ ਜਾਂਦੀ ਆ ਤੇ ਮਤਲਬ ਕਿਆ ਹੀ ਕਹਿਣੇ ਗੁਰੂ ਜੀ ਦੇ ਉਹਨਾਂ ਦੇ ਕੀ ਉਹਨਾਂ ਦੀ ਮਹਿਮਾ ਦੇਖੋ ਕਿ ਬੰਦਾ ਖੁਦ ਉਹਨਾਂ ਨੇ ਆਪਣਾ ਜਿਹੜਾ ਬਚਪਨ ਆ ਉਹ ਨਾ ਭੁੱਖੇ ਗੁਜਾਰਿਆ ਆ ਪਰ ਉਹਨਾਂ ਦੇ ਜਿਹੜੇ ਦਰਬਾਰ 'ਤੇ ਇੱਕ ਵਾਰੀ ਸੰਗਤ ਪਹੁੰਚ ਜਾਵੇ ਉਹ ਕਦੀ ਭੁੱਖੇ ਢਿੱਡ ਨਹੀਂ ਜਾਂਦੀ ਕ੍ਰਿਪਾ ਹੈ ਗੁਰੂ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ